ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਨੂੰ ਸੁਧਾਰ ਕਰਨ ਲਈ ਕਈ ਮੁੱਖ ਪਹਿਲ ਕਦਮੀਆਂ ਅਤੇ ਪ੍ਰੋਗਰਾਮ ਤਿਆਰ ਕੀਤੇ ਹੋਏ ਹਨ ਜਿਵੇਂ ਕਿ ਟੀਚਰ ਟ੍ਰੇਨਿੰਗ ਸਿਸਟਮ ਇਹ ਸਿਸਟਮ ਵਧੀਆ ਟੀਚਰਸ ਨੂੰ ਤਿਆਰ ਕਰਦਾ ਹੈ ਜੋ ਵਿਦਿਆਰਥੀਆਂ ਨੂੰ ਅਧਿਕ ਸਮਝ ਰੱਖਣ ਵਿੱਚ ਮੱਦਦਗਾਰ ਹੁੰਦਾ ਹੈ ਅਤੇ ਵਿਦਿਆਰਥੀਆਂ ਦਾ ਲਰਨਿੰਗ ਐਕਸਪੀਰੀਅਸ ਵੀ ਵੱਧਦਾ ਹੈ ਇਸ ਤੋਂ ਇਲਾਵਾ ਐਕਸਟਰਾ ਕਰੀਕੁਲਰ ਐਕਟੀਵਿਟੀਸ ਜਿਵੇਂ ਕਿ ਗੇਮ ਪੀਰੀਅਡ ਜਿਸ ਵਿੱਚ ਸਪੋਰਟਸ ਜਿਵੇਂ ਕਿ ਕ੍ਰਿਕੇਟ ਫੁੱਟਬੋਲ ਬੈਡਮਿੰਟਨ ਆਦਿ ਰੱਖੇ ਜਾ ਸਕਦੇ ਹਨ ਜੋ ਵਿਦਿਆਰਥੀਆਂ ਦੇ ਮਾਨਸਿਕ ਅਤੇ ਸਰੀਰਕ ਦੋਨਾਂ ਲਈ ਲਾਭਦਾਇਕ ਹੁੰਦਾ ਹੈ ਇਸ ਤੋਂ ਹੱਟ ਕੇ ਮਿਊਜਿਕ ਦੇ ਪੀਰੀਅਡ ਵੀ ਰੱਖ ਸਕਦੇ ਹਾਂ ਜਿਸ ਨਾਲ ਬੱਚਿਆਂ ਨੂੰ ਪੜ੍ਹਾਈ ਤੋਂ ਇਲਾਵਾ ਹੋਰ ਐਕਟੀਵਿਟੀਜ਼ ਵਿੱਚ ਵੀ ਇੰਟਰਸਟ ਪੈਦਾ ਹੁੰਦਾ ਹੈ ਅਤੇ ਵਿਦਿਆਰਥੀਆਂ ਦਾ ਵਿਕਾਸ ਹੁੰਦਾ ਹੈ ਸਕੂਲ ਸਿੱਖਿਆ ਦੀ ਰੀਸਟਰਕਚਰਿੰਗ ਜਿਵੇਂ ਕਿ ਅਕੈਡਮਿਕ ਐਕਟੀਵਿਟੀਜ਼ ਵਿੱਚ ਮੋਡਰਨਾਈਜ਼ੇਸ਼ਨ ਕਰਕੇ ਅਸੀਂ ਵਿਦਿਆਰਥੀਆਂ ਲਈ ਸਿੱਖਿਆ ਨੂੰ ਆਸਾਨ ਬਣਾਉਂਦੇ ਹਾਂ ਇਸ ਤਰ੍ਹਾਂ ਵਿਦਿਆਰਥੀਆਂ ਦਾ ਲਰਨਿੰਗ ਐਕਸਪੀਰੀਅਸ ਵੱਧਦਾ ਹੈ ਅਤੇ ਵਿਦਿਆਰਥੀਆਂ ਦਾ ਮਨੋਵਿਕਾਸ ਹੁੰਦਾ ਹੈ ਇਹਨਾਂ ਤਿੰਨਾਂ ਪਹਿਲ ਕਦਮੀਆਂ ਨਾਲ ਸਿੱਖਿਆ ਪ੍ਰਣਾਲੀ ਵਿੱਚ ਵਿਕਾਸ ਹੁੰਦਾ ਹੈ ਅਤੇ ਇਹ ਪਹਿਲ ਕਦਮੀ ਬਹੁਤਾ ਅਸਰ ਰੱਖਦੇ ਹਨ